ਜਿਵੇਂ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਆਦਤ ਨਹੀਂ ਹੁੰਦੀ ਕਿ ਮੰਜੇ 'ਤੇ ਪੈਣ ਅਤੇ ਉਹਨਾਂ ਨੇ ਸਾਰੀ ਜ਼ਿੰਦਗੀ ਕੰਮ ਕੀਤਾ ਹੁੰਦਾ ਹੈ ਜਾਂ ਤਾਂ ਉਹ ਕਦੇ ਵੀ ਇੱਦਾਂ ਨਹੀਂ ਸੋਚਦੇ ਕਿ ਆਪਾਂ ਮੰਜੇ 'ਤੇ ਪਈਏ ਪਰ ਕੁਛ ਕਾਰਨਾਂ ਕਰਕੇ ਜਿਵੇਂ ਕਿ ਜਿਵੇਂ ਬਿਮਾਰ ਹੋ ਜਾਂਦੇ ਨੇ ਉਹ ਜਾਂ ਫਿਰ ਜਿਵੇਂ ਕਈ ਵਾਰ ਥੱਕ ਹਾਰ ਕੇ ਆਉਂਦੇ ਤਾਂ ਕਰਕੇ ਉਹ ਮੰਜੇ 'ਤੇ ਪੈ ਜਾਂਦੇ ਹੈ ਅਤੇ ਇਸ ਕਰਕੇ ਉਹਨਾਂ ਨੂੰ ਵੀ ਮਤਲਬ ਸਿਹਤ ਸੁਹਤ ਖ਼ਰਾਬ ਹੋ ਜਾਂਦੀ ਹੈ ਤਾਂ ਕਰਕੇ ਮੰਜੇ 'ਤੇ ਪੈ ਜਾਂਦੇ ਉਹ ਨਹੀਂ ਤਾਂ ਉਹ ਸ਼ੁਰੂ ਤੋਂ ਹੀ ਫਿਜੀਕਲ ਮਤਲਬ ਕੰਮ 'ਚ ਇਨਵੋਲਵ ਹੁੰਦੇ ਐਕਟੀਵਿਟੀ ਕਰਦੇ ਹੁੰਦੇ ਹੈ ਪਰ ਉਹ ਕਦੇ ਵੀ ਇੱਦਾਂ ਮੰਜੇ 'ਤੇ ਨਹੀਂ ਪੈਂਦੇ ਹੈਗੇ ਉਹ ਹਮੇਸ਼ਾ ਆਪਣੇ ਕੰਮ ਨੂੰ ਵੀ ਤਰਜੀਹ ਦਿੰਦੇ ਹਨ ਅਤੇ ਸਾਡੇ ਪਿੰਡਾਂ ਵਿੱਚ ਨਾ ਪਰਿਵਾਰਕ ਮੈਂਬਰ ਉਹਨਾਂ ਦੀ ਦੇਖਭਾਲ ਬੜੀ ਹੀ ਚੰਗੀ ਤਰੀਕੇ ਨਾਲ ਕਰਦੇ ਹਨ ਉਹ ਉਹਨਾਂ ਦੀ ਦੇਖਭਾਲ ਜਿਵੇਂ ਉਹਨਾਂ ਦੀ ਦਵਾਈ ਉਹਨਾਂ ਦੇ ਸਾਰੀ ਜਿਵੇਂ ਵੀ ਉਹਨਾਂ ਦੇ ਕੱਪੜੇ ਬਦਲਣੇ ਜਾਂ ਹ ਸਾਰੇ ਉਹਨਾਂ ਦੇ ਕੰਮ ਉਹਨਾਂ ਨੇ ਖੁਦ ਨਾਲ ਹੋ ਕੇ ਕਰਵਾਉਣੇ ਹੈ ਤਾਂ ਜਦੋਂ ਉਹ ਮੰਜੇ 'ਤੇ ਪੈ ਜਾਂਦੇ ਹੈ ਅਤੇ ਉਹ ਖੁਦ ਸਾਰੇ ਹੀ ਕੰਮ ਕਰਵਾਉਂਦੇ ਨੇ ਉਹ ਖੁਦ ਉਹਨਾਂ ਨੂੰ ਲੈ ਕੇ ਜਾਂਦੇ ਆ ਖੁਦ ਉਹਨਾਂ ਦੀ ਦਵਾਈ ਦਾ ਧਿਆਨ ਰੱਖਦੇ ਆ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਦੇ ਉਹਨਾਂ ਦੇ ਕੱਪੜੇ ਲੀੜੇ ਦਾ ਸਭ ਕੁਛ ਚੀਜ਼ਾਂ ਦਾ ਉਹ ਖੁਦ ਧਿਆਨ ਰੱਖਦੇ ਹਨ ਅਤੇ ਸਾਡੇ ਪਿੰਡਾਂ ਵਿੱਚ ਕਾਫੀ ਤਰਜੀਹ ਦਿੱਤੀ ਜਾਂਦੀ ਆਪਣੇ ਬਜ਼ੁਰਗਾਂ ਨੂੰ ਆਪਣੇ ਚੰਗੀ ਤਰ੍ਹਾਂ ਰੱਖਣ ਦੀ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਹ ਸਾਂਭ ਸੰਭਾਲ ਕਰਨ ਦੀ ਕਾਫੀ ਹੀ ਤਰਜੀਹ ਦਿੱਤੀ ਜਾਂਦੀ ਹੈ